ਹੁਨਰਾਂ ਦੀ ਗੱਲ ਕਰੀਏ ਤਾਂ ਮੇਰੇ ਵਿੱਚ ਕਾਫੀ ਹੁਨਰ ਹੈ ਜਿਵੇਂ ਖਾਣਾ ਬਣਾਉਣਾ ਕਿਤਾਬਾਂ ਪੜ੍ਹਨਾ ਘੁੰਮਣਾ ਫਿਰਨਾ ਇਸ ਤੋਂ ਇਲਾਵਾ ਗੁਰਦੁਆਰੇ ਵਿੱਚ ਜਾ ਕੇ ਸੇਵਾ ਕਰਨਾ ਪਾਠ ਕਰਨਾ ਮੈਨੂੰ ਬਹੁਤ ਜ਼ਿਆਦਾ ਪਸੰਦ ਹਨ ਇਸ ਤੋਂ ਇਲਾਵਾ ਮੈਂ ਕੱਪੜੇ ਸਿਉਣਾ ਵਿਸ਼ੇਸ਼ ਹੁਨਰ ਹੈ ਮੇਰੇ ਵਿੱਚ ਕਿਉਂਕਿ ਮੈਂ ਕੱਪੜੇ ਆਪਣੇ ਘਰਦਿਆਂ ਦੇ ਪਰਿਵਾਰ ਦੇ ਮੈਂਬਰਾਂ ਦੇ ਸਟਿਚ ਕਰਦੀ ਹਾਂ ਇਸ ਤੋਂ ਇਲਾਵਾ ਮੈਨੂੰ ਹੌਲੀ ਹੌਲੀ ਕਾਫੀ ਜ਼ਿਆਦਾ ਕੰਮ ਮਿਲਿਆ ਜੋ ਕਿ ਮੇਰਾ ਕੰਮ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਮੈਂ ਵੱਖ ਵੱਖ ਤਰੀਕੇ ਦੇ ਕੱਪੜੇ ਬਣਾਉਂਦੀ ਹਾਂ ਅਤੇ ਇਹ ਰੋਜ਼ਗਾਰ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਮੈਂ ਇਸ ਦੇ ਜ਼ਰੀਏ ਕਾਫੀ ਪੈਸੇ ਵੀ ਕਮਾ ਰਹੀ ਹਾਂ ਅਤੇ ਮੇਰੇ ਲੋਕ ਕੱਪੜੇ ਬਹੁਤ ਪਸੰਦ ਕਰਦੇ ਹਨ ਸਟਿਚ ਕੀਤੇ